ਸਭ ਤੋਂ ਵਿਦੇਸ਼ੀ ਸਮੱਗਰੀ ਜਿਹੜੀ ਅੱਜ ਕੱਲ੍ਹ ਮਿਓਨੀਸ ਹੈ ਇਹ ਵਿਦੇਸ਼ੀ ਸਮੱਗਰੀ ਹੈ ਜੋ ਕਿ ਲੋਕ ਅੱਜ ਕੱਲ੍ਹ ਬਰੇਕਫਾਸਟ ਕਰਦੇ ਸਮੇਂ ਜਿਹੜੇ ਕਿ ਸੈਂਡਵਿੱਚਸ ਵਗੈਰਾ ਬਣਾਉਂਦੇ ਹਨ ਉਹਨਾਂ ਵਿੱਚ ਵੀ ਪਾਉਂਦੇ ਹਨ ਮਿਓਨੀਸ ਜਿਹੜੀ ਹੈ ਲੋਕ ਜਿਵੇਂ ਕਿ ਕੋਈ ਪਾਸਤਾ ਬਣਾ ਰਹੇ ਹਨ ਵਾਈਟ ਸੋਸ ਪਾਸਤਾ ਜਿਹਨੂੰ ਕਿ ਆਪਾਂ ਬਹੁਤ ਚੰਗੀ ਤਰ੍ਹਾਂ ਨਾਮ ਜਾਣਦੇ ਹਾਂ ਉਹ ਇਹ ਪਾਸਤਾ ਜਿਹੜਾ ਉਹ ਉਹਦੇ ਵਿੱਚ ਹੀ ਮਿਓ ਉਹਦੇ ਵਿੱਚ ਵੀ ਮਿਓਨੀਸ ਜਿਹੜੀ ਆ ਵਰਤੀ ਜਾਂਦੀ ਹੈ ਇਹ ਜਿਹੜਾ ਹੈ ਬਹੁਤ ਜ਼ਿਆਦਾ ਜਿਹੜਾ ਇਸ ਸਮੱਗਰੀ ਦਾ ਜਿਹੜਾ ਇਸਤੇਮਾਲ ਹੋ ਰਿਹਾ ਹੈ ਅੱਜ ਕੱਲ੍ਹ ਖਾਣੇ ਨੂੰ ਟੇਸਟੀ ਬਣਾਉਣ ਲਈ ਲੋਕ ਇਹ ਚੀਜ਼ਾਂ ਜਿਹੜੀਆਂ ਹਨ ਉਹ ਵਰਤੋਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੈ ਕੇ ਆ ਰਹੇ ਹਨ ਪਹਿਲਾਂ ਦੇ ਸਮੇਂ ਵਿੱਚ ਜਿੱਦਾਂ ਦਾਲ ਦੂਲ ਬਣਾਉਣ ਲਈ ਲੋਕ ਜਿਹੜਾ ਹੈ ਮੱਖਣ ਘੀ ਵਗੈਰਾ ਦਾ ਇਸਤੇਮਾਲ ਕਰਦੇ ਸੀ ਪਰ ਅੱਜ ਕੱਲ੍ਹ ਜਿਹੜਾ ਜ਼ਿਆਦਾਤਰ ਇਹ ਮਿਓਨੀਸ ਵਗੈਰਾ ਜਿਹੜੀਆਂ ਉਹ ਖਾਣੇ ਦੇ ਵਿੱਚ ਪਾਈਆਂ ਜਾਂਦੀਆਂ ਹਨ